ਹੈਲੋ ਡ੍ਰਾਈਵਰ ਕੈਬ ਮੈਂ ਬਲਜੀਤ ਕੌਰ ਮੈਂ ਕੱਲ੍ਹ ਤੁਹਾਡੀ ਐਪ ਤੋਂ ਇੱਕ ਕੈਬ ਬੁੱਕ ਕੀਤੀ ਸੀ ਮੈਂ ਮਾਨਸਾ ਤੋਂ ਬਠਿੰਡਾ ਜਾਣਾ ਸੀ ਮੈਂ ਹਰ ਵਾਰੀ ਤੁਹਾਡੀ ਐਪ ਤੋਂ ਕੈਬ ਬੁੱਕ ਕਰਦੀ ਹਾਂ ਜਿਸ ਕਰਕੇ ਮੈਂ ਕੱਲ੍ਹ ਵੀ ਤੁਹਾਡੀ ਐਪ ਤੋਂ ਕੈਬ ਬੁੱਕ ਕੀਤੀ ਪਰ ਮੇਰੇ ਤੋਂ ਗਲਤੀ ਨਾਲ ਗਲਤ ਅਡਰੈਸ ਦਿੱਤਾ ਗਿਆ ਮੈਂ ਮਾਨਸਾ ਤੋਂ ਬਠਿੰਡਾ ਜਾਣਾ ਸੀ ਪਰ ਮੇਰੇ ਤੋਂ ਮਾਨਸਾ ਦੀ ਜਗ੍ਹਾ ਬੁਢਲਾਡੇ ਤੋਂ ਬਠਿੰਡਾ ਲਿਖਿਆ ਗਿਆ ਇਸ ਲਈ ਡ੍ਰਾਈਵਰ ਕੈਬ ਲੈ ਕੇ ਗਲਤ ਸਥਾਨ 'ਤੇ ਪਹੁੰਚ ਗਏ ਜਦੋਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਆਪਣਾ ਅਡਰੈਸ ਚੈੱਕ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਤੋਂ ਅਡਰੈਸ ਗਲਤ ਭਰਿਆ ਗਿਆ ਤਾਂ ਮੈਂ ਡ੍ਰਾਈਵਰ ਨੂੰ ਸਹੀ ਜਗ੍ਹਾ ਦਾ ਪਤਾ ਦਿੱਤਾ ਮੈਂ ਸਵੇਰੇ ਦਸ ਵਜੇ ਬਠਿੰਡੇ ਪਹੁੰਚਣਾ ਸੀ ਮੈਨੂੰ ਬਹੁਤ ਜਲਦੀ ਸੀ ਮੇਰੀ ਫਰੈਂਡ ਉੱਥੇ ਮੇਰਾ ਵੇਟ ਕਰ ਰਹੀ ਸੀ ਪਰ ਜਦੋਂ ਡ੍ਰਾਈਵਰ ਕੈਬ ਲੈ ਕੇ ਆਏ ਤਾਂ ਮੈਂ ਉਦੋਂ ਬਹੁਤ ਲੇਟ ਹੋ ਚੁੱਕੀ ਸੀ ਜਿਸ ਕਰਕੇ ਮੈਂ ਬਠਿੰਡੇ ਜਾਣਾ ਕੈਂਸਲ ਕਰ ਦਿੱਤਾ ਅਤੇ ਜਿਸ ਕਰਕੇ ਮੈਂ ਇਹ ਕੈਬ ਵੀ ਬੁੱਕ ਕੈਂਸਲ ਕਰ ਦਿੱਤੀ ਧੰਨਵਾਦ